ਪੇਂਡੂ ਲੋਕ ਖੇਡਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਪੇਂਡੂ ਲੋਕ ਰੱਸਾ ਕੱਸੀ ਕਬੱਡੀ ਕ੍ਰਿਕਟ ਸਾਰੀਆਂ ਖੇਡਾਂ ਨੂੰ ਪੂਰੀ ਮਹੱਤਤਾ ਦਿੰਦੇ ਹਨ ਪੇਂਡੂ ਲੋਕ ਖੇਡਾਂ ਵਾਲੇ ਇਸ ਕਰਕੇ ਵੀ ਜ਼ਿਆਦਾ ਧਿਆਨ ਦਿੰਦੇ ਹਨ ਕਿ ਉਹਨਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਪੇਂਡੂ ਲੋਕ ਖੇਡਾਂ ਦੇ ਮੇ ਖੇਡ ਮੇਲੇ ਕਰਾਉਂਦੇ ਹਨ ਤਾਂ ਜੋ ਕਿ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਛੋਟੇ ਬੱਚੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਖੇਡਣ ਪੇਂਡੂ ਲੋਕ ਖੇਡਾਂ ਖੇਡਾਂ ਕਰਾਉਣ ਦੇ ਸ਼ੌਕੀਨ ਹਨ ਪੇਂਡੂ ਲੋਕ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਜਿੱਤਣ ਵਾਲੇ ਖਿਡਾਰੀਆਂ ਨੂੰ ਇਨਾਮ ਦਿੰਦੇ ਹਨ ਅਤੇ ਉਹਨਾਂ ਨੂੰ ਸਨਮਾਨਿਤ ਕਰਦੇ ਹਨ ਜਿਨਾਂ ਨੂੰ ਦੇਖ ਕੇ ਛੋਟੇ ਬੱਚੇ ਖੇਡਣ ਦਾ ਸ਼ੌਂਕ ਪੈਦਾ ਕਰਦੇ ਹਨ ਜਿਸ ਨਾਲ ਪੇਂਡੂ ਲੋਕ ਹਰੇਕ ਪਿੰਡ ਵਿੱਚ ਜਿਮ ਅਤੇ ਖੇਡਾਂ ਦੇ ਸਮਾਨ ਨੂੰ ਤਰਜੀਹ ਦਿੰਦੇ ਹਨ ਬੇਸ਼ੱਕ ਉਹਨਾਂ ਨੂੰ ਇਹ ਸਮਾਨ ਆਪਣੀ ਜੇਬ ਵਿੱਚੋਂ ਖ਼ਰਚ ਕੇ ਲਿਆਉਣਾ ਪਵੇ ਬੱਚਿਆਂ ਦੇ ਖੇਡਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਕਿ ਬੱਚੇ ਖੇਡਾਂ ਵਿੱਚ ਅੱਗੇ ਹੋਣ ਅਤੇ ਉਹਨਾਂ ਦੇ ਪਿੰਡਾਂ ਦੇ ਨਾਮ ਚਮਕਾਉਣ ਖੇਡਾਂ ਵਿੱਚ ਉਹ ਖੇਡ ਮੇਲੇ ਵੀ ਕਰਵਾਉਂਦੇ ਹਨ